ਵਿੱਚ ਕਾਫ਼ੀ ਸਾਰੇ ਪ੍ਰਸਿੱਧ ਪ੍ਰਸਾਨ ਪ੍ਰਤਸਾਨਕ ਬੈਂਡ ਜਾਂ ਸੰਗੀਤਕਾਰ ਮੌਜੂਦ ਨੇ ਜਿਵੇਂ ਕਿ ਮਿਊਸੀਕਲ ਗਰੁੱਪਸ ਨੇ ਇੰਟਰਨੈਸ਼ਨਲ ਪੰਜਾਬੀ ਢੋਲ ਹੈ ਝਣਕਾਰ ਔਰਚੈਂਸਟਾ ਪਰ ਇਨ੍ਹਾਂ ਵਿੱਚੋਂ ਸਭ ਤੋਂ ਪ੍ਰਸਿੱਧ ਜਿਹੜਾ ਹੈ ਉਹ ਇੰਟਰਨੈਸ਼ਨਲ ਪੰਜਾਬੀ ਢੋਲ ਹੈ ਸਰਕਾਰ ਕਈ ਵਧੀਆ ਮੌਕਾ ਮੌਕਿਆਂ 'ਤੇ ਇਨ੍ਹਾਂ ਨੂੰ ਹੀ ਬੁਲਾਉਂਦੀ ਹੈ ਜਿਵੇਂ ਕਿ ਛੱਬੀ ਜਨਵਰੀ ਹੋ ਗਿਆ ਪੰਦਰਾਂ ਅਗਸਤ ਹੋ ਗਿਆ ਇਹ ਆਪਣਾ ਵਧੀਆ ਪਰਫੋਮ ਕਰਦੇ ਨੇ ਅਤੇ ਇਨ੍ਹਾਂ ਦਾ ਜਿਹੜਾ ਪਰਫੋਮ ਕਰਨ ਦਾ ਤਰੀਕਾ ਬਹੁਤ ਹੀ ਅਲੱਗ ਹੈ ਇਹ ਟਾਈਮ ਸਿਰ ਪਹੁੰਚਦੇ ਨੇ ਅਤੇ ਇਨ੍ਹਾਂ ਦਾ ਜਿਹੜਾ ਪਰਫੋਮ ਕਰਨ ਦਾ ਤਰੀਕਾ ਵੀ ਕਾਫ਼ੀ ਵਧੀਆ ਲੱਗਦਾ ਹੈ ਸਰਕਾਰ ਨੂੰ ਤਾਂ ਇਨ੍ਹਾਂ ਨੂੰ ਹਰੇਕ ਮੌਕਿਆਂ 'ਤੇ ਬੁਲਾਇਆ ਜਾਂਦਾ ਹੈ ਹਰੇਕ ਫੰਕਸ਼ਨ 'ਤੇ ਇਨ੍ਹਾਂ ਨੂੰ ਸੱਦਾ ਦੇ ਦਿੱਤਾ ਜਾਂਦਾ ਇਹ ਸਾਡੇ ਘਰ ਦੇ ਥੋੜ੍ਹੀ ਜਿਹੀ ਦੂਰੀ 'ਤੇ ਹੀ ਰਹਿੰਦੇ ਨੇ ਅਤੇ ਕਾਫ਼ੀ ਵਿਆਹ ਸ਼ਾਦੀਆਂ 'ਚ ਵੀ ਇਨ੍ਹਾਂ ਨੂੰ ਬੁਲਾ ਲਿਆ ਜਾਂਦਾ ਹੈ ਤਾਂ ਇਨ੍ਹਾਂ ਦਾ ਜਿਹੜਾ ਬੈਂਡ ਹੈ ਬਹੁਤ ਹੀ ਜ਼ਿਆਦਾ ਮਸ਼ਹੂਰ ਹੋ ਗਿਆ ਹੈ ਇਨ੍ਹਾਂ ਇਸ ਕੰਮ ਕਰਕੇ